ਵੈਸੇ ਤਾਂ ਪਰਿਵਾਰਿਕ ਪਕਵਾਨਾਂ ਵਿੱਚ ਬਹੁਤ ਸਾਰੇ ਪਕਵਾ ਪਕਵਾਨ ਹਨ ਜਿਵੇਂ ਦਾਲ਼ ਦਾਲ਼ ਰੋਟੀ ਸਾਗ ਮੱਕੀ ਦੀ ਰੋਟੀ ਅਤੇ ਆਲ ਆਲੂ ਵਾਲੀ ਰੋਟੀ ਕਾਫੀ ਤਰ੍ਹਾਂ ਦੇ ਪਕਵਾਨ ਹਨ ਅਤੇ ਜੋ ਮੈਂ ਆਪਣੀ ਮਾਤਾ ਤੋਂ ਸਿੱਖੇ ਹਨ ਉਹ ਹਨ ਗੁਲਗੁਲੇ ਕਚੋਰੀਆਂ ਅਤੇ ਮੈਂ ਉਸਨੂੰ ਬਣਾਉਂਦੀ ਹਾਂ ਅਤੇ ਮੈਂ ਤੁਹਾਨੂੰ ਉਸ ਉਸਦੀ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੀ ਹਾਂ ਅਤੇ ਉਹ ਰੈਸਪੀ ਹੈਗੀ ਆ ਗੁਲਗਲੇ ਗੁਲਗੁਲਿਆਂ ਦਾ ਆਟਾ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਕੋਲੀ ਆਟੇ ਦੀ ਲਵਾਂਗੇ ਅਤੇ ਉਸ ਵਿੱਚ ਥੋੜ੍ਹਾ ਗੁੜ ਪਹਿਲਾਂ ਗੁੜ ਨੂੰ ਭਿਉਂ ਕੇ ਰੱਖਾਂਗੇ ਜਿਹੜਾ ਉਹ ਪਾਣੀ ਹੋਵੇਗਾ ਗੁੜ ਵਾਲ਼ਾ ਅਤੇ ਉਹ ਗੁੜ ਗੁੜ ਵਾਲ਼ੇ ਪਾਣੀ ਨਾਲ ਅਸੀਂ ਆਟਾ ਗੁੰਨਾਂਗੇ ਅਤੇ ਉਸਨੂੰ ਥੋੜ੍ਹਾ ਪਤਲਾ ਕਰ ਲਵਾਂਗੇ ਆਟੇ ਨੂੰ ਅਤੇ ਉਸਨੂੰ ਜਦੋਂ ਕੜਾਹੀ ਦੇ ਵਿੱਚ ਤੇਲ ਗਰਮ ਹੋਜੂਗਾ ਤਾਂ ਉਸਨੂੰ ਗੋਲ ਗੋਲ ਕਰਕੇ ਅਸੀਂ ਕੜਾਹੀ ਦੇ ਵਿੱਚ ਛੱਡ ਦੇਵਾਂਗੇ ਅਤੇ ਉਹ ਜਦੋਂ ਫਰਾਈ ਹੋ ਕੇ ਪੱਕ ਜਾਣਗੇ ਤਾਂ ਉਸਨੂੰ ਅਸੀਂ ਕੱਢ ਦੇਵਾਂਗੇ ਅਤੇ ਉਸ ਤੋਂ ਬਾਅਦ ਕਚੋਰੀਆਂ ਦੀ ਰੈਸਪੀ ਕਚੋਰੀਆਂ ਦੀ ਰੈਸਪੀ ਦੇ ਵਿੱਚ ਪਹਿਲਾਂ ਅਸੀਂ ਆਲੂਆਂ ਨੂੰ ਉਬਾਲਾਂਗੇ ਆਲੂ ਉਬਾਲਣ ਤੋਂ ਬਾਅਦ ਉਸਨੂੰ ਚੰਗੀ ਤਰ੍ਹਾਂ ਮੈਸ਼ ਕਰਾਂਗੇ ਮੈਸ਼ ਕਰਨ ਤੋਂ ਬਾਅਦ ਉਸ ਵਿੱਚ ਪਿਆਜ਼ ਹਰੀ ਮਿਰਚ ਧਨੀਆਂ ਜੀਰਾ ਲੂਣ ਮਿਰਚ ਹਲਦੀ ਆਦਿ ਉਸ ਵਿੱਚ ਪਾਵਾਂਗੇ ਅਤੇ ਉਸ ਤੋਂ ਬਾਅਦ ਆਟ ਆਟਾ ਗੁੰਨ ਲਵਾਂਗੇ ਆਟਾ ਥੋੜ੍ਹਾ ਪਤਲਾ ਰੱਖਾਂਗੇ ਅਤੇ ਉਸ ਤੋਂ ਬਾਅਦ ਆਟਾ ਗੁੰਨਣ ਤੋਂ ਬਾਅਦ ਉਸਦੀ ਇੱਕ ਛੋਟੀ ਜਿਹੀ ਲੋਈ ਕਰ ਲਵਾਂਗੇ ਲੋਈ ਕਰਕੇ ਉਸ ਵਿੱਚ ਆਲੂ ਆਲੂ ਦਾ ਮੈਸ਼ ਪਾ ਦੇਵਾਂਗੇ ਮੈਸ਼ ਪਾਉਣ ਤੋਂ ਬਾਅਦ ਉਸਨੂੰ ਹੱਥ ਦੇ ਨਾਲ਼ ਗੋਲ ਗੋਲ ਵੇਲ ਲਵਾਂਗੇ ਗੋਲ ਵੇਲਣ ਤੋਂ ਬਸ ਉਸਨੂੰ ਕੜਾਹੀ ਦੇ ਵਿੱਚ ਛੱਡ ਦੇਵਾਂਗੇ ਤੇਲ ਵਾਲ਼ੀ ਕੜਾਹੀ ਦੇ ਵਿੱਚ ਜਦੋਂ ਉਹ ਚੰਗੀ ਤਰ੍ਹਾਂ ਪੱਕ ਜਾਵੇਗੀ ਤਾਂ ਉਸਨੂੰ ਅਸੀਂ ਬਾਹਰ ਕੱਢ ਦੇਵਾਂਗੇ